ਪੰਜਾਬ ਵਿੱਚ ਫਸਲਾਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਹਨ ਲੇਕਿਨ ਅੱਜ ਦੇ ਮਾਹੌਲ ਮੁਤਾਬਕ ਫਸਲ ਝੋਨਾ ਜ਼ਿਆਦਾ ਮਾਰਕੀਟ ਵਿੱਚ ਆਉਂਦਾ ਹੈ ਝੋਨੇ ਤੋਂ ਕਿਸਾਨ ਕਈ ਤਰ੍ਹਾਂ ਦੇ ਫਾਇਦੇ ਲੈਂਦੇ ਹਨ ਕਿਉਂਕਿ ਇਸ ਫਸਲ ਵਿੱਚ ਬਹੁਤ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਬਿਜਾਈ ਕਰਨ ਨਾਲ ਉਸ ਤੋਂ ਬਾਅਦ ਸਮੇਂ ਸਮੇਂ ਅਨੁਸਾਰ ਪਾਣੀ ਦੇ ਦਿੱਤਾ ਜਾਂਦਾ ਹੈ ਤਾਂ ਕਿਸਾਨ ਆਪਣੇ ਆਪ ਨੂੰ ਵਿਹਲਾ ਜਿਹਾ ਸਮਝ ਕੇ ਫਸਲ ਤੋਂ ਇੱਕ ਪਾਸੇ ਹੋ ਕੇ ਆਪਣੇ ਘਰ ਆਰਾਮ ਕਰਦਾ ਹੈ ਇਸ ਨੂੰ ਮਾਰਕੀਟ ਵਿੱਚ ਲਿਆਉਣਾ ਵੀ ਸੌਖਾ ਹੈ ਕਿਉਂਕਿ ਇਹ ਫਸਲ ਪੰਜਾਬ ਦੇ ਹਰ ਸ਼ਹਿਰ ਅਤੇ ਮੁੱਖ ਪਿੰਡਾਂ ਦੇ ਵਿੱਚ ਮੰਡੀਆਂ 'ਚ ਲਿਆਈ ਜਾਂਦੀ ਹੈ ਲਿਆਉਣ ਲਈ ਜਿਹੜੇ ਸਾਧਨ ਹਨ ਅੱਜ ਛੋਟੇ ਮੋਟੇ ਕਿਸਾਨ ਕੋਲ ਵੀ ਟਰੈਕਟਰ ਟਰਾਲੀ ਹੈ ਔਰ ਝੋਨਾ ਜਲਦੀ ਸਰਕਾਰ ਚੁੱਕ ਲੈਂਦੀ ਹੈ ਦੂਸਰਿਆਂ ਸੂਬਿਆਂ ਵਿੱਚ ਜੇ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਤਾਂ ਖਰਚੇ ਬਹੁਤ ਪੈਂਦੇ ਹਨ ਵੇਚਣ ਵਾਸਤੇ ਵਿਚੋਲੀਏ ਰੱਖਣੇ ਪੈਂਦੇ ਹਨ ਵਿਚੋਲੀਏ ਵਪਾਰੀ ਇਹਦੇ ਵਿੱਚੋਂ ਕੁਛ ਤਾਂ ਫਸਲਾਂ ਦੀ ਬੋਰੀਆਂ ਉਤਾਰ ਲੈਂਦੇ ਹਨ ਕੁਛ ਉਹ ਆਪਦੇ ਹਿਸਾਬ ਨਾਲ ਰੇਟ ਫਿਕਸ ਕਰਕੇ ਦੂਜੀ ਮੰਡੀਆਂ 'ਚ ਜਾਂ ਦੂਜੇ ਸੂਬਿਆਂ ਵਿੱਚ ਸਸਤੇ ਰੂਪ ਵਿੱਚ ਹੀ ਵਿਕਾਉਂਦੇ ਹਨ ਉਹ ਮਹਿੰਗਾ ਨਹੀਂ ਹੁੰਦਾ ਅਸੀਂ ਕਈ ਚੀਜ਼ਾਂ ਦੇਖਦੇ ਹਾਂ ਜਿਸ ਤਰ੍ਹਾਂ ਅੱਜ ਕੱਲ੍ਹ ਦੀਆਂ ਸਬਜ਼ੀਆਂ ਸਬਜ਼ੀਆਂ ਅਸੀਂ ਲੈਂਦੇ ਹਾਂ ਪਿੰਡਾਂ ਤੋਂ ਲਿਆ ਕੇ ਸ਼ਹਿਰ ਵਿੱਚ ਵੇਚਦੇ ਹਾਂ ਲੇਕਿਨ ਉਹ ਹੀ ਜੇ ਅਸੀਂ ਦੂਜੇ ਹੁਸ਼ਿਆਰਪੁਰ ਅਤੇ ਜਲੰਧਰ ਜਾਂ ਹੋਰ ਦੂਰ ਦਰਾਜ ਦੀਆਂ ਜਿੱਥੇ ਕੋਈ ਸਬਜ਼ੀਆਂ ਨਹੀਂ ਹੁੰਦੀਆਂ ਜਿੱਥੇ ਅਸੀਂ ਲੈ ਕੇ ਜਾਦੇ ਹਾਂ ਉਹ ਮਹਿੰਗੀਆਂ ਤਾਂ ਜ਼ਰੂਰ ਵਿਕਦੀਆਂ ਹਨ ਲੇਕਿਨ ਉਹਨੂੰ ਖਰੀਦਣ ਵਾਲੇ ਐਨੀ ਮਹਿੰਗੀ ਸਬਜ਼ੀ ਨੂੰ ਕਿਵੇਂ ਖਰੀਦ ਸਕਦੇ ਹਨ ਜਿਵੇਂ ਕਲਾਲੀ ਹੈ ਜਾਂ ਪੇਠੇ ਦੀ ਸਬਜ਼ੀ ਜਿਹੜੀ ਰਾਜਸਥਾਨ ਤੋਂ ਆਉਂਦੀ ਹੈ ਔਰ ਹੁਸ਼ਿਆਰਪੁਰ ਵਿੱਚ ਵਿਕਦੀ ਹੈ ਜਾਂ ਹੁਸ਼ਿਆਰਪੁਰ ਦੀਆਂ ਸਬਜ਼ੀਆਂ ਰਾਜਸਥਾਨ ਜਾਂਦੀਆਂ ਹਨ ਟਰੱਕਾਂ ਦੇ ਟਰੱਕ ਉਹ ਸਬਜ਼ੀ ਦਸ ਰੁਪਏ ਕਿਲੋ ਵੀ ਹੋਵੇ ਤਾਂ ਉਹ ਦੂਜੇ ਸੂਬੇ ਵਿੱਚ ਜਾ ਕੇ ਚਾਲੀ ਰੁਪਏ ਜਾਂ ਪੰਜਾਹ ਰੁਪਏ ਮਿਲਦੀ ਹੈ ਉਹਨੂੰ ਲੋਕ ਖਰੀਦਣਾ ਪਸੰਦ ਨਹੀਂ ਕਰਦੇ ਇਸ ਕਰਕੇ ਉਹ ਆਪਣਾ ਸਿਸਟਮ ਠੀਕ ਨਹੀਂ ਹੈ ਕਰ ਸਕਦੇ ਪਰ ਵਪਾਰੀ ਇਹ ਚਾਹੁੰਦਾ ਹੈ ਕਿ ਮੈਨੂੰ ਥੋੜ੍ਹੀ ਮਿਹਨਤ ਨਾਲ ਬਹੁਤ ਸਾਰੇ ਪੈਸੇ ਮਿਲ ਜਾਣ